ਨਮਸਕਾਰ ਜੀ ਚੰਦਨ ਕਾਲੜਾ ਗੱਲ ਕਰ ਰਿਹਾਂ ਫ਼ਾਜ਼ਿਲਕਾ ਸਿਟੀ ਤੋਂ ਮੈਂ ਐਮਾਜੋਨ 'ਤੇ ਕਾਲ ਕੀਤੀ ਹੈ ਅਤੇ ਮੇਰੀ ਜ਼ਰੂਰਤ ਹੈ ਕਿ ਮੈਨੂੰ ਇੱਕ ਡੈਲ ਦਾ ਲੈਪਟਾਪ ਚਾਹੀਦਾ ਜਿਹਦੀ ਲੇਟੈਸਟ ਕਨਫੀਗਰੇਸ਼ਨ ਹੋਵੇ ਸਾਰੀ ਅਤੇ ਇਹਦੇ 'ਚ ਮੈਂ ਜਾਣਨਾ ਚਾਹੁੰਦਾ ਕਿ ਲੇਟੈਸਟ ਕਿਹੜਾ ਮਾਡਲ ਅਵੇਲੇਬਲ ਹੈਗਾ ਤੁਹਾਡੇ ਕੋਲ ਅਤੇ ਹੋਰ ਕੀ ਗੱਲ ਹੈ ਕਿ ਲੇਟੈਸਟ ਕਨਫੀਗਰੇਸ਼ਨ ਹੋਣੀ ਚਾਹੀਦੀ ਹੈ ਅਤੇ ਇਹਦਾ ਪ੍ਰਾਈਸ ਕੀ ਹੈ ਅਤੇ ਇਹਦੇ 'ਚ ਕੋਈ ਡਿਸਕਾਊਂਟ ਚੱਲ ਰਿਹਾ ਹੈ ਦਿਵਾਲੀ ਦਾ ਕੋਈ ਫੈਸਟੀਵ ਡਿ ਡਿਸਕਾਊਂਟ ਚੱਲ ਰਿਹਾ ਹੈ ਉਸ ਬਾਰੇ 'ਚ ਵੀ ਵੀ ਵੀ ਮੈਂ ਜਾਣਨਾ ਚਾਹੁੰਦਾ ਹਾਂ ਕਿ ਮੈਂ ਅਤੇ ਨਾਲੇ ਇਹਦੇ ਪੇਇੰਗ ਜਿਹੜੇ ਮੈਥਡਸ ਨੇ ਕੈਸ਼ ਕੈਸ਼ ਓਨ ਡਿਲੀਵਰੀ ਕਰੈਡਿਟ ਕਾਰਡ ਜਾਂ ਜਿਹੜੇ ਵੀ ਮੈਥਡਸ ਹੈਗੇ ਨੇ ਉਹਦੇ 'ਤੇ ਕੀ ਡਿਸਕਾਊਂਟਸ ਨੇ ਮੈਂ ਇਹ ਵੀ ਚ ਜਾਣਨਾ ਚਾਹ ਰਿਹਾ ਹਾਂ ਇਹਦੇ 'ਚ ਕਲਰਸ ਕਿਹੜੇ ਕਿਹੜੇ ਅਵੇਲੇਬਲ ਨੇ ਮੈਂ ਉਹ ਵੀ ਜਾਣਨਾ ਚਾਹੁੰਦਾ ਹਾਂ ਕਿਉਂਕਿ ਮੈਨੂੰ ਬਲੈਕ ਕਲਰ ਨਹੀਂ ਚਾਹੀਦਾ ਇਹਦੇ ਰੈੱਡ ਹੋਵੇ ਜਾਂ ਕੋਈ ਹੋਰ ਕਲਰ ਹੋਵੇ ਉਹ ਮੈਨੂੰ ਚਾਹੀਦਾ ਹੈ ਇਹ ਮੈਂ ਜਾਣਨਾ ਚਾਹੁੰਦਾ ਹਾਂ ਹੋਰ ਇਹਦੇ ਨਾਲ ਹੋਰ ਅਸੈਸਰੀਜ਼ ਕਿਹੜੀ ਕਿਹੜੀ ਅਵੇਲੇਬਲ ਹੈਗੀਆਂ ਤੁਹਾਡੇ ਕੋਲ